ਮੈਨੂੰ ਯੋਗ ਕਰਨਾ ਬਹੁਤ ਹੀ ਚੰਗਾ ਲੱਗਦਾ ਹੈ ਯੋਗ ਕਰਨ ਨਾਲ ਸਰੀਰ ਸਾਡਾ ਚੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਅਗਰ ਗੱਲ ਕੀਤੀ ਜਾਵੇ ਸਰੀਰਿਕ ਅਤੇ ਮਾਨਸਿਕਨ ਚੁਣੌਤੀਆਂ ਦੀ ਤਾਂ ਮੈਂ ਇੱਕ ਦੋ ਸਰੀਰਿਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਸਰੀਰਿਕ ਚੁਣੌਤੀਆਂ ਦੇ ਵਿੱਚ ਸਰੀਰ ਦੇ ਵਿੱਚ ਲਚਕੀਲਾਪਨ ਘੱਟ ਹੋਰਨ ਹੋਣ ਦੇ ਕਾਰਨ ਕਾਫੀ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕੀਤਾ ਆਸਣ ਕਰਨ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਲ ਲਗਾਤਾਰ ਪ੍ਰੈਕਟਿਸ ਕਰਨ ਦੇ ਨਾਲ ਉਸ ਚੀਜ਼ ਨੂੰ ਮੈਂ ਠੀਕ ਵੀ ਕੀਤਾ ਹੈ ਪ੍ਰੈਕਟਿਸ ਦੇ ਲਈ ਮੈਂ ਕਾਫੀ ਸਾਰੇ ਯੋਗੀਆਂ ਦੀ ਹੈਲਪ ਵੀ ਲਈ ਹੈ ਅਤੇ ਕਾਫੀ ਯੋਗੀਆਂ ਦੀ ਸਲਾਹ ਮਸ਼ਵਰਾ ਵੀ ਲਿਆ ਹੈ ਇਸ ਤੋਂ ਇਲਾਵਾ ਮੈਂ ਸੋਸ਼ਲ ਮੀਡੀਆ ਦੀ ਹੈਲਪ ਦੇ ਨਾਲ ਵੀ ਯੋਗ ਕਰਨ ਦੇ ਸਹੀ ਤਰੀਕਿਆਂ ਦਾ ਪਤਾ ਲਗਾਇਆ ਹੈ ਸਹੀ ਤਰੀਕੇ ਨਾਲ ਯੋਗ ਕਰਨ ਦੇ ਵਿੱਚ ਕੋਈ ਵੀ ਸਰੀਰਿਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਅਗਰ ਸਾਨੂੰ ਯੋਗ ਦੇ ਬਾਰੇ ਘੱਟ ਨੌਲੇਜ ਹੈ ਤਾਂ ਸਾਨੂੰ ਇੱਕ ਵਾਰ ਚੰਗੀ ਤਰੀਕੇ ਦੇ ਨਾਲ ਉਸਦੇ ਨਾਲ ਰਿਲੇਟਡ ਚੀਜ਼ਾਂ ਨੂੰ ਪੜ੍ਹ ਕੇ ਹੀ ਤੇ ਉਸਦੇ ਉੱਤੇ ਅਮਲ ਕਰਕੇ ਹੀ ਸਾਨੂੰ ਯੋਗ ਕਰਨਾ ਚਾਹੁੰਦਾ ਚਾਹੀਦਾ ਹੈ ਨਹੀਂ ਤਾਂ ਕਾਫੀ ਸਾਰੀਆਂ ਚੁਣੌਤੀਆਂ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੇਨ ਚੀਜ਼ ਇਹੀ ਹੈ ਕਿ ਸਰੀਰ ਦੇ ਵਿੱਚ ਲਚਕੀਲਾਪਨ ਹੋਣਾ ਲੇਕਿਨ ਲਚਕੀਲਾਪਨ ਪੂਰੀ ਤਰ੍ਹਾਂ ਲਿਆਉਣ ਦੇ ਵਿੱਚ ਸਰੀਰ ਦੇ ਲਈ ਸਾਨੂੰ ਲਗਾਤਾਰ ਉਸ ਚੀਜ਼ 'ਤੇ ਦੁਬਾਰਾ ਦੁਬਾਰਾ ਪ੍ਰੈਕਟਿਸ ਕਰਨੀ ਪੈਣੀ ਹੈ ਅਗਰ ਆਪਾਂ ਪ੍ਰੈਕਟਿਸ ਦੇ ਨਾਲ ਉਸ ਚੀਜ਼ ਨੂੰ ਲਚਕੀਲਾਪਨ ਜ਼ਿਆਦਾ ਲਿਆ ਸਕਦੇ ਹਾਂ ਇਸ ਨਾਲ ਸਾਡੀ ਜਿਹੜੀਆਂ ਹੈ ਕੋਈ ਵੀ ਚੁਣੌਤੀਆਂ ਨਹੀਂ ਰਹਿਣਗੀਆਂ ਅਤੇ ਅਸੀਂ ਆਪਣਾ ਯੋਗ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਹਰ ਰੋਜ਼ ਕਰ ਸਕਦੇ ਹਾਂ